ਮੋਹਾਲੀ ਜ਼ਿਲ੍ਹੇ ਵਿੱਚ ਮੌਸਮ ਹਰੇਕ ਤਰ੍ਹਾਂ ਦਾ ਆਉਂਦਾ ਹੈ ਇੱਥੇ ਗਰਮੀਆਂ ਵੀ ਹੁੰਦੀਆਂ ਹਨ ਅਤੇ ਇੱਥੇ ਸਰਦੀਆਂ ਵੀ ਹੁੰਦੀਆਂ ਹਨ ਇੱਥੇ ਪਤਝੜ ਵੀ ਹੁੰਦੀ ਹੈ ਅਤੇ ਇੱਥੇ ਬਰਸਾਤ ਵੀ ਹੁੰਦੀ ਹੈ ਅਤੇ ਪੰਜਾਬ ਇੱਕ ਐਸਾ ਸੂਬਾ ਹੈ ਜਿਸ ਵਿੱਚ ਹਰੇਕ ਤਰ੍ਹਾਂ ਦਾ ਮੌਸਮ ਹੁੰਦਾ ਹੈ ਅਤੇ ਸਾਨੂੰ ਹਰੇਕ ਤਰ੍ਹਾਂ ਦੇ ਮੌਸਮ ਵਿੱਚ ਵੀ ਚੱਲਣਾ ਚਾਹੀਦਾ ਹੈ ਇਸ ਵਿੱਚ ਜਿਹੜੀ ਗਰਮੀ ਹੈ ਕਈ ਵਾਰ ਅੱਤ ਨਾਲੋਂ ਗਰਮੀ ਬਹੁਤ ਪੈਂਦੀ ਹੈ ਸਰਦੀਆਂ ਵਿੱਚ ਕਈ ਵਾਰ ਅੱਤ ਨਾਲੋਂ ਸਰਦੀ ਬਹੁਤ ਜ਼ਿਆਦਾ ਪੈਂਦੀ ਹੈ ਅਤੇ ਸਰਦੀਆਂ ਵਿੱਚ ਅਸੀਂ ਇਹੀ ਕਹਿੰਦੇ ਹਾਂ ਵੀ ਸਰਦੀ ਘੱਟ ਜਾ ਜਾਵੇ ਗਰਮੀਆਂ ਵਿੱਚ ਅਸੀਂ ਇਹ ਹੀ ਕਹਿੰਦੇ ਹਾਂ ਅਤੇ ਗਰਮੀ ਘੱਟ ਜਾਵੇ